ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਸਾਰੇ ਹੈ ਸਾਡੇ ਕੋਲ ਜਿੱਦਾਂ ਮੈਨਸ ਦੇ ਹੈ ਕੁੜਤੇ ਪਜਾਮੇ ਹੈ ਪੱਗਾਂ ਕੈਂਠੇ ਜੁੱਤੇ ਹਾਂਜੀ ਹਾਂਜੀ ਕਲਰ ਤਾਂ ਤੁਹਾਨੂੰ ਜਿਹੜਾ ਮਰਜ਼ੀ ਕਲਰ ਕਹੋਗੇ ਉਹ ਮਿਲ ਸਕਦਾ ਹੈ ਅਤੇ ਕੁਆਲਟੀ ਵੀ ਇਹਦੀ ਤੁਹਾਨੂੰ ਵਧੀਆ ਮਿਲੂਗੀ ਹਾਂਜੀ ਠੀਕ ਹੈ ਜੀ ਹਾਂਜੀ ਕੁੜੀਆਂ ਵਾਸਤੇ ਵੀ ਇੱਥੇ ਬਹੁਤ ਚੀਜ਼ਾਂ ਹੈਗੀਆਂ ਹੈ ਹਾਂਜੀ ਲਹਿੰਗੇ ਵਗੈਰਾ ਵੀ ਹੈ ਸੂਟ ਦੇ ਕੱਪੜੇ ਵੀ ਹੈ ਠੀਕ ਹੈ ਜੀ ਤੁਹਾਨੂੰ ਕੁਆਲਟੀ ਵਾਈਜ ਇਹ ਸਭ ਕੁਛ ਤੁਸੀਂ ਇੱਕ ਵਾਰੀ ਹੈ ਕੇ ਸਾਡੀ ਸ਼ੋਪ 'ਤੇ ਦੇਖ ਜਿਓ ਹਾਂਜੀ ਮੇਰੇ ਕੱਪੜੇ ਜਿਹੜੇ ਹੈ ਉਹ ਸਿੰਗਰ ਵਗੈਰਾ ਵੀ ਪਾਉਂਦੇ ਹੈ ਹਾਂਜੀ ਕੱਪੜੇ ਦੀ ਵੀ ਗਰੰਟੀ ਹੋਵੇਗੀ ਤੁਹਾਨੂੰ ਕੱਪੜੇ ਦੀ ਕੁਆਲਟੀ ਵੀ ਵਧੀਆ ਮਿਲੇਗੀ ਹਾਂਜੀ ਠੀਕ ਹੈ ਜੀ ਚਲੋ ਫਿਰ ਠੀਕ ਹੈ ਜੀ ਮਿਲਦੇ ਹਾਂ ਮੈਂ ਤੁਹਾਨੂੰ ਆਪਣਾ ਐਡਰੈਸ ਵਗੈਰਾ ਵੱਟਸਅੱਪ ਕਰ ਦੇਣਾ ਜੇ ਐਡਰੈਸ ਨਹੀਂ ਪਤਾ ਹੋਏ ਤੁਹਾਨੂੰ ਠੀਕ ਹੈ ਜੀ ਧੰਨਵਾਦ